ਫੋਰੇਸਟ ਡਿਪਾਰਟਮੈਂਟ ਤੋਂ ਬੋਲ ਰਹੇ ਹੋ ਅਤੇ ਮੈਂ ਨਾ ਫਾਜ਼ਿਲਕਾ ਸ਼ਹਿਰ 'ਚ ਪੰਜਾਬ 'ਚ ਨਾ ਰੁੱਖ ਲਾਉਣੇ ਨੇ ਤਾਂ ਤੁਸੀਂ ਕਿਹੜੇ ਕਿਹੜੇ ਰੁੱਖ ਲਾਓਗੇ ਕਿ ਫਾਜ਼ਿਲਕਾ ਸ਼ਹਿਰ ਹਰਾ ਭਰਿਆ ਦਿਖੇ ਅਤੇ ਵਧੀਆ ਸਾਫ ਵਾਤਾਵਰਨ ਬਣਿਆ ਰਹੇ ਹਾਂ ਹਾਂ ਫਾਜ਼ਿਲਕਾ 'ਚ ਨਾ ਵੈਸੇ ਬਹੁਤ ਕਮ ਰੁੱਖ ਲੱਗੇ ਹੋਏ ਨੇ ਅਤੇ ਇੱਥੇ ਬਹੁਤ ਹੀ ਪਲਿਊਸ਼ਨ ਹੈਗਾ ਤਾਂ ਇਸ ਕਰਕੇ ਨਾ ਤੁਸੀਂ ਜ਼ਿਆਦਾ ਰੁੱਖ ਲਾਇਓ ਜੇ ਤਾਂਕਿ ਜਲਵਾਯੂ ਵਗੈਰਾ ਅਤੇ ਪ੍ਰਦੂਸ਼ਣ ਵਗੈਰਾ ਘੱਟ ਹੋਵੇ ਪਰ ਸਾਡੇ ਹਾਂਜੀ ਤੁਸੀਂ ਉਹ ਲਾ ਜਾਇਓ ਜੀ ਠੀਕ ਹੈ ਨਾ ਅਤੇ ਇਹ ਤਾਂ ਹੂੰ ਇ ਇਹ ਤਾਂ ਗੱਲ ਤੁਸੀਂ ਠੀਕ ਹੀ ਕੀਤੀ ਹੈ ਅਸੀਂ ਰੁੱਖਾਂ ਨਾਲ ਹੀ ਸਾਡਾ ਜੀਵਨ ਹੀ ਹੈਗਾ ਜੇ ਰੁੱਖੀ ਨਹੀਂ ਤਾਂ ਅਸੀਂ ਕੀ ਹਾਂ ਅਤੇ ਇਹਦੀ ਦੇਖ ਰੇਖ ਕੌਣ ਕਰੂਗਾ ਤੁਸੀਂ ਆਓਗੇ ਟਾਈਮ ਟਾਈਮ 'ਤੇ ਅਤੇ ਖਾਦ ਵਗੈਰਾ ਅਤੇ ਪਾਣੀ ਵਗੈਰਾ ਵੀ ਅਸੀਂ ਤਾਂ ਦੇਵਾਂਗੇ ਹੀ ਅੱਛਾ ਠੀਕ ਹੈ ਅਤੇ ਕੀੜੇਮਾਰ ਵਗੈਰਾ ਦ ਦਵਾਈ ਵਗੈਰਾ ਵੀ ਦਿਆ ਕਰੋ ਤੁਸੀਂ ਠੀਕ ਹੈ ਹਾਂ ਚਲੋ ਹਾਂ ਹਾਂ ਅਤੇ ਹਾਂਜੀ ਠੀਕ ਹੈ